ਮੈਂ ਕਈ ਸਾਰੀਆਂ ਪੰਜਾਬੀ ਕਹਾਵਤਾਂ ਜਾਂ ਮੁਹਾਵਰੇ ਸੁਣਦੀ ਰਹਿੰਦੀ ਹਾਂ ਜਿੱਦਾਂ ਪੰਜਾਬੀ ਕਹਾਵਤਾਂ ਵਿੱਚ ਜਿੱਦਾਂ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਇਹ ਜਿਹੜੀ ਕਹਾਵਤ ਆ ਇਹ ਯੂਜ਼ ਕੀਤੀ ਜਾਂਦੀ ਹੈ ਉਸ ਬੰਦੇ ਲਈ ਜਿਹੜਾ ਕਿ ਹਰ ਜਗ੍ਹਾ 'ਤੇ ਮਿਲ ਜਾਂਦਾ ਹੈ ਜਿੱਦਾਂ ਕਿ ਔਰ ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ ਮਤਲਬ ਇਹ ਜਿਹੜੀ ਕਹਾਵਤ ਆ ਉਹਦੇ ਲਈ ਯੂਜ ਕੀਤੀ ਜਾਂਦੀ ਹੈ ਕਿ ਕੋਈ ਵੀ ਇਨਸਾਨ ਆ ਉਹ ਜਿਹੜਾ ਕੰਮ ਕਰਨ ਦੇ ਇਹ ਬਣੀ ਹੈ ਜੈਸੇ ਹੋਰ ਕੋਈ ਆ ਉਦਾਹਰਨਾਂ ਜਿੱਦਾਂ ਕਿ ਸੋਚੀ ਪਿਆ ਬੰਦਾ ਗਿਆ ਮਤਲਬ ਕੋਈ ਵੀ ਚੀਜ਼ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਕਈ ਸਾਰੇ ਮੁਹਾਵਰੇ ਵੀ ਮੈਂ ਸੁਣਦੀ ਰਹਿੰਦੀ ਹਾਂ ਜਿੱਦਾਂ ਕਿ ਨੌਂ ਦੋ ਗਿਆਰ੍ਹਾਂ ਹੋਣਾ ਵੈਸੇ ਹੀ ਬੋਲ ਦਿੰਦੇ ਆ ਕਿ ਚੋਰ ਨੂੰ ਦੇਖ ਕੇ ਪੁਲਿਸ ਨੂੰ ਦੇਖ ਕੇ ਜਿਹੜਾ ਚੋਰ ਆ ਉਹ ਨੌਂ ਦੋ ਗਿਆਰ੍ਹਾਂ ਹੋ ਗਿਆ ਉੱਚਾ ਸਾਹ ਨਹੀਂ ਕੱਢਣਾ ਸਹਿਮ ਜਾਣਾ ਜਿਹੜੇ ਮਾਪਿਆਂ ਅੱਗੇ ਨਹੀਂ ਬੋਲਦੇ ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ ਮਤਲਬ ਜਿਹੜੇ ਮਾਪਿਆਂ ਅੱਗੇ ਬੋਲਦੇ ਰਹਿੰਦੇ ਆ ਬੱਚੇ ਉਹ ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਡਦੇ ਜਿੱਦਾਂ ਕਿ ਉਸਤਾਦੀ ਕਰਨਾ ਚਲਾਕੀ ਕਰਨੀ ਗੁਰਨਾਮ ਬਹੁਤ ਚਲਾਕ ਹੈ ਉਸਦੇ ਨਾਲ ਕੋਈ ਉਸਤਾਦੀ ਨਹੀਂ ਕਰ ਸਕਦਾ ਇੱਦਾਂ ਦੀਆਂ ਕਈ ਸਾਰੀਆਂ ਉਦਾਹਰਣਾਂ ਹੋ ਸਕਦੀਆਂ ਧੰਨਵਾਦ